ਮੈਂ ਵੀਹ ਦਿਨ ਪਹਿਲਾਂ ਰੈਡਮੀ ਦਾ ਫ਼ੋਨ ਮੰਗਵਾਇਆ ਸੀ ਫਲਿੱਪਕਾਰਡ ਤੋਂ ਮੈਂ ਉਹ ਕੱਲ੍ਹ ਰਸੀਵ ਕੀਤਾ ਮੈਂ ਬਹੁਤ ਖੁਸ਼ ਹੋਈ ਬਹੁਤ ਹੀ ਵਧੀਆ ਪੈਕਜਿੰਗ ਸੀ ਉਹਦੀ ਅਤੇ ਮੈਂ ਜਦੋਂ ਮਤਲਬ ਪੈਕਜਿੰਗ ਨੂੰ ਖੋਲ੍ਹਿਆ ਅਤੇ ਉਸ ਦਾ ਡਿਸਪਲੇਅ ਵਗੈਰਾ ਬਹੁਤ ਵਧੀ ਵਧੀਆ ਸੀ ਅਤੇ ਫਿਰ ਮੈਂ ਮਤਲਬ ਉਹਨੂੰ ਔਨ ਕੀਤਾ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਮਤਲਬ ਉਹ ਫ਼ੋਨ ਰਿਸੀਵ ਕਰਕੇ ਅਤੇ ਮੈਨੂੰ ਮਤਲਬ ਜਿ ਜਿਵੇਂ ਮਤਲਵ ਜੈਸੇ ਔ ਔਫਲਾਈਨ ਸੋਪਿੰਗ ਕਰਤੇ ਹੈ ਕਰਦੇ ਹਾਂ ਮਤਲਬ ਉਹ ਤਾਂ ਬਹੁਤ ਵਧੀਆ ਸੀ ਔਫਲਾਈਨ ਸੋਪਿੰਗ ਮੈਨੂੰ ਦੋ ਮਤਲਬ ਦੋ ਹਜ਼ਾਰ ਰੁਪਏ ਮਤਲਬ ਪ੍ਰੋਫਿਟ ਵੀ ਹੋਇਆ ਹੈ ਫਿਰ ਅਤੇ ਮੈਂ ਮੈਂ ਕਿ ਮੈਂ ਅਪਣੇ ਮੈਂ ਕਿਹਾ ਮਤਲਬ ਮੈਂ ਆਪਣੀ ਮੰਮੀ ਵਾਸਤੇ ਮੰਗਵਾਉਂਗੀ ਇੱਕ ਅਤੇ ਆਪਣੇ ਫਰੈਂਡਾਂ ਨੂੰ ਵੀ ਕਿਹਾ ਕਿ ਮਤਲਬ ਤੁਸੀਂ ਵੀ ਮੰਗਾਇਓ ਬਹੁਤ ਵਧੀਆ ਫ਼ੋਨ ਹੈ ਅਤੇ ਵਧੀਆ ਹੈ ਬਹੁਤ ਜ਼ਿਆਦਾ ਹੀ ਵਧੀਆ ਹੈ ਅਤੇ ਮੈਂ ਇਹਨੂੰ ਮਤਲਬ ਤਿੰਨ ਘੰਟੇ ਚਲਾਇਆ ਦਸ ਪ੍ਰਤੀਸੈਂਟ ਹੀ ਮਤਲਬ ਬੈਟਰੀ ਖ਼ਤਮ ਹੋਈ ਅਤੇ ਇ ਇਹਦਾ ਬੈਟਰੀ ਬੈਕਅੱਪ ਵੀ ਬਹੁਤ ਵਧੀਆ ਹੈ